ਸਾਡੀ ਗਾਇਕੀ ਵਿੱਚ ਭਾਵਨਾ ਦੀ ਭੂਮਿਕਾ ਬਹੁਤ ਹੀ ਇੰਪੋਰਟੈਂਟ ਮੰਨੀ ਜਾਂਦੀ ਹੈ ਅਗਰ ਸਾਡੀ ਗਾਇਕੀ 'ਚ ਭਾਵਨਾ ਨਹੀਂ ਹੋਣਗੀਆਂ ਅਤੇ ਇੱਕ ਅਸੀਂ ਗਾਣਾ ਗਾ ਹੀ ਨਹੀਂ ਸਕਦੇ ਗਾਣਾ ਗਾਉਣ ਲਈ ਮਨ 'ਚ ਅੱਛੀ ਭਾਵਨਾਵਾਂ ਅਤੇ ਅੱਛੀ ਭੂਮਿਕਾ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਇੱਕ ਗਾਣਾ ਬਣਦਾ ਹੈ ਉਹ 'ਚ ਸਾਰੇ ਤਰ੍ਹਾਂ ਦੀ ਲੋਕਾਂ ਦੀ ਭਾਵਨਾ ਨੂੰ ਲੈ ਕੇ ਆਪਣੇ ਆਪ ਦੀ ਭਾਵਨਾ ਨੂੰ ਲੈ ਕੇ ਸਮਾਜ ਦੀ ਭਾਵਨਾ ਨੂੰ ਨਜ਼ਰਅੰਦਾਜ਼ ਨਾ ਕਰਕੇ ਵਧੀਆ ਬੋਲ ਲਿਖੇ ਜਾਂਦੇ ਹਨ ਬੋਲਾਂ ਦੀ ਓਨੀ ਹੀ ਇਮਪੋਰਟੈਂਟ ਹੈ ਜਿੰਨੇ ਗਾਣੇ ਦੀ ਹੈ ਅਗਰ ਤੁਹਾਡੇ ਬੋਲ ਬਹੁਤ ਵਧੀਆ ਹੈ ਤਾਂ ਗਾਣਾ ਓਨਾ ਹੀ ਵਧੀਆ ਨਿਕਲੇਗਾ ਤੁਸੀਂ ਉਹਨਾਂ ਨੂੰ ਆਪਣੀ ਗਾਇਕੀ ਵਿੱਚ ਤਾਂ ਹੀ ਪ੍ਰਗਟ ਕਰ ਸਕਦੇ ਹੋ ਜਦੋਂ ਤੁਹਾਨੂੰ ਇੱਕ ਅੱਛੇ ਬੋਲ ਲਿਖੇ ਹੋਣਗੇ ਬੋਲ ਦੇ ਕਰਕੇ ਹੀ ਅਸੀਂ ਗਾਣਾ ਗਾਉਣ ਵਾਲਾ ਬੰਦਾ ਵੀ ਆਪਣੇ ਬੋਲਾਂ ਕਰਕੇ ਬਹੁਤ ਹੀ ਸੋਹਣਾ ਗਾਣਾ ਗਾ ਦਿੰਦਾ ਹੈ ਅਤੇ ਓਨੀ ਹੀ ਉਹਦੀ ਕਲਾਕਾਰੀ ਦੀ ਵਿਆਖਿਆ ਹੁੰਦੀ ਹੈ ਅੱਛਾ ਸਿੰਗਰ ਉਹੀ ਹੈ ਜੋ ਚੰਗੇ ਬੋਲ ਲਿਖ ਕੇ ਬੋਲ ਕੇ ਅਤੇ ਅੱਛੇ ਗਾਣੇ 'ਚ ਉਹਨੂੰ ਲੈ ਕੇ ਜਾ ਸਕਦਾ ਹੈ ਇਸ ਲਈ ਸਾਨੂੰ ਬੋਲਾਂ ਦੀ ਅਤੇ ਭਾਵਨਾਵਾਂ ਦੀ ਬਹੁਤ ਵੱਡੀ ਭੂਮਿਕਾ ਮਿਲਦੀ ਹੈ